ਪੰਜ ਸੌ ਬਿਆਸੀ ਨੌ ਹਜ਼ਾਰ ਤਿੰਨ ਸੌ ਸੈਂਤੀ ਅਠਵੰਜਾ ਹਜ਼ਾਰ ਸੱਤ ਸੌ ਬਾਨਵੇਂ ਸੱਤ ਲੱਖ ਪਚਾਨਵੇਂ ਹਜ਼ਾਰ ਇੱਕ ਸੌ ਉੱਨੀ ਛਿਆਨਵੇਂ